ਇੱਕ ਦਿਨ ਵਿੱਚ ਮੇਰੀ ਖੁਰਾਕ ਵਿੱਚ ਜੋ ਜੋ ਚੀਜ਼ਾਂ ਸ਼ਾਮਿਲ ਹਨ ਉਹ ਵੈਸੀਆਂ ਨਹੀਂ ਜੈਸੀਆਂ ਕਿ ਆਮ ਪ੍ਰਚੱਲਿਤ ਲੋਕ ਖਾਂਦੇ ਹਨ ਸਮਾਜ ਵਿੱਚ ਤੁਸੀਂ ਦੇਖਦੇ ਹੋ ਕਿ ਅਗਰ ਵਿਅਕਤੀ ਤਿੰਨ ਟਾਇਮ ਵੀ ਖਾਣਾ ਖਾਂਦਾ ਹੈ ਤਾਂ ਉਸ ਵਿੱਚ ਉਹ ਅਗਰ ਪੰਜਾਬ ਹਰਿਆਣਾ ਹਿਮਾਚਲ ਅਤੇ ਆਦਿ ਇਲਾਕੇ ਵਿੱਚ ਤੁਸੀਂ ਰਹਿੰਦੇ ਹੋ ਯੂ ਪੀ ਬਿਹਾਰ ਵੀ ਤਾਂ ਰੋਟੀਆਂ 'ਤੇ ਬਹੁਤਾ ਜੋਰ ਦਿੱਤਾ ਜਾਂਦਾ ਹੈ ਸਾਨੂੰ ਲੱਗਦਾ ਹੈ ਕਿ ਰੋਟੀ ਮਿਲ ਗਈ ਸਾਡਾ ਸੰਪੂਰਨ ਆਹਾਰ ਹੋ ਗਿਆ ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿੰਨੇ ਵੀ ਅੰਨ ਹਨ ਤੁਸੀਂ ਦੇਖਦੇ ਹੋ ਖੇਤਾਂ ਵਿੱਚ ਉਗਾਇਆ ਜਾਂਦਾ ਹੈ ਤਾਂ ਬਿਨਾਂ ਖਾਦਾ ਦੇ ਬਿਨਾਂ ਯੂਰੀਆ ਦੇ ਕੋਈ ਵੀ ਅੰਨ ਪੈਦਾ ਨਹੀਂ ਹੋ ਰਿਹਾ ਇਸ ਲਈ ਜੋ ਪੇਟ ਗੈਸ ਹੋਣੀ ਜਾਂ ਜੋੜਾਂ ਦੇ ਦਰਦ ਹੋਣੇ ਯੂਰਿਕ ਐਸਿਡ ਵਧਣਾ ਕੋਲੈਸਟਰੋਲ ਵਧਣਾ ਕੇਵਲ ਅਗਰ ਰੋਟੀ ਹੀ ਤੁਸੀਂ ਆਪਣੇ ਖਾਣੇ ਵਿੱਚ ਰੱਖੋਂਗੇ ਸਬਜ਼ੀ ਰੋਟੀ ਤਾਂ ਸਾਡੀ ਸਿਹਤ ਲਈ ਫ਼ਾਇਦੇਮੰਦ ਨਹੀਂ ਹੈ ਇਸ ਲਈ ਮੇਰੀ ਖੁਰਾਕ ਵਿੱਚ ਕੀ ਹੈ ਮੈਂ ਰੋਟੀ ਸਿਰਫ਼ ਇਹ ਖਾਂਦਾ ਹਾਂ ਲੇਕਿਨ ਨਾਲ ਮੱਠਾ ਮਤਲਬ ਲੱਸੀ ਅਤੇ ਸਬਜ਼ੀ ਵੱਧ ਖਾਂਦਾ ਹਾਂ ਔਰ ਸਬਜ਼ੀ ਵਿੱਚ ਵੀ ਮੈਂ ਕੋਈ ਮਸਾਲਾ ਨਹੀਂ ਪਾਉਂਦਾ ਸਿੰਪਲ ਸਬਜ਼ੀ ਸਾਦੀ ਸਬਜ਼ੀ ਅਤੇ ਉਹ ਤੇਲ ਘੱਟ ਹੁੰਦਾ ਉਹਦੇ ਵਿੱਚ ਅਤੇ ਨਾਲ ਮੈਂ ਫਲਾਂ ਨੂੰ ਜ਼ਿਆਦਾ ਤਰਜੀਹ ਦਿੰਦਾ ਹਾਂ ਅਤੇ ਮੈਂ ਦੋ ਟਾਈਮ ਆਹਾਰ ਕਰਦਾ ਹਾਂ ਤੇ ਇਹ ਮੰਨ ਕੇ ਚੱਲਦਾ ਹੈ ਕਿ ਅਗਰ ਮੇਰੇ ਸਰੀਰ ਵਿੱਚ ਸੌ ਪਰਸੈਂਟ ਮੇਰੇ ਪੇਟ ਵਿੱਚ ਸੋ ਪਰਸੈਂਟ ਭੋਜਨ ਦੀ ਸਮਰੱਥਾ ਹੈ ਤਾਂ ਮੈਂ ਕੇਵਲ ਸੱਤਰ ਜਾਂ ਅੱਸੀ ਪਰਸੈਂਟ ਦੇ ਵਿੱਚ ਵਿੱਚ ਭੋਜਨ ਨੂੰ ਗ੍ਰਹਿਣ ਕਰਦਾ ਹਾਂ ਅਤੇ ਇਸ ਨਾਲ ਕੀ ਹੈ ਕਿ ਮੇਰਾ ਪਾਚਨ ਤੰਤਰ ਸਹੀ ਰਹਿੰਦਾ ਹੈ ਅਤੇ ਮੇਰੀ ਸਿਹਤ ਸਹੀ ਰਹਿੰਦਾ ਹੈ ਧੰਨਵਾਦ